ਜ਼ਿਆਦਾਤਰ ਸਕੂਲੀ ਪੜ੍ਹਾਈ ਤੋਂ ਬਾਅਦ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰਨ ਜਾਂਦੇ ਹੀ ਨੇ ਜ਼ਿਆਦਾਤਰ ਅਤੇ ਕਈ ਐਸੇ ਵੀ ਹੁੰਦੇ ਨੇ ਅਜਿਹੇ ਵੀ ਹੁੰਦੇ ਨੇ ਜਿਹਨਾਂ ਨੂੰ ਆਪਣੇ ਪਾਰਿਵਾਰਿਕ ਕਾਰੋਬਾਰ ਨੂੰ ਵੇਖਣਾ ਜਾ ਜਾਏਂਦਾ ਪੈਂਦਾ ਹੁੰਦਾ ਹੈ ਜਿਵੇਂ ਕਿ ਸੌ ਬੱਚਿਆਂ ਦੀ ਇੱਕ ਕਲਾਸ ਹੈਗੀ ਹੈ ਵਿਦਿਆਰਥੀ ਜਿਸ 'ਚ ਸੌ ਨੇ ਉਹਨਾਂ ਚੋਂ ਮੈਂ ਇਹ ਸਮਝਦੀ ਹਾਂ ਕਿ ਜਿਹੜੇ ਨੱਬੇ ਹੈ ਉਹ ਉੱਚ ਸ਼ਿਕਸ਼ਾ ਲੈਂਦੇ ਹੀ ਲੈਂਦੇ ਹੈ ਉਹਨਾਂ ਵਿੱਚੋਂ ਦਸ ਹੁੰਦੇ ਨੇ ਜਿਹਨਾਂ ਦਾ ਕੁਝ ਪਰਿਵਾਰਿਕ ਕਾਰੋਬਾਰ ਹੁੰਦਾ ਹੈ ਅਤੇ ਉਹ ਅੱਗੇ ਉੱਚ ਸ਼ਿਕਸ਼ਾ ਲੈਣਾ ਜ਼ਰੂਰੀ ਨਹੀਂ ਸਮਝਦੇ ਪਰ ਅਜਿਹਾ ਵੀ ਨਹੀਂ ਕਿ ਜਿਨ੍ਹਾਂ ਦੇ ਪਰਿਵਾਰਿਕ ਕਾਰੋਬਾਰ ਹੁੰਦੇ ਹੈ ਉਹ ਉੱਚ ਸ਼ਿਕਸ਼ਾ ਨਹੀਂ ਲੈਂਦੇ ਉਹ ਉਹਨਾਂ ਦੀ ਆਪਣੀ ਮਰਜ਼ੀ ਵੀ ਹੁੰਦੀ ਹੈ ਕਈਆਂ ਨੂੰ ਉੱਚ ਸ਼ਿਕਸ਼ਾ ਲੈਣਾ ਬਹੁਤ ਜ਼ਰੂਰੀ ਲੱਗਦਾ ਚਾਹੇ ਉਹਨਾਂ ਦੇ ਪਰਿਵਾਰਿਕ ਕਾਰੋਬਾਰ ਜੋ ਵੀ ਹੋਣ ਅਤੇ ਜਿਹੜੇ ਗੱਲ ਆਉਂਦੀ ਹੈ ਕਿ ਆਪਣੇ ਖੇਤਰ 'ਚ ਨੌਕਰੀ ਕਰਨ ਲਈ ਜਾਣਾ ਬਿਲਕੁਲ ਜ਼ਿਆਦਾਤਰ ਬੱਚੇ ਜਿਹੜੇ ਵੀ ਖੇਤਰ 'ਚ ਉੱਚ ਸ਼ਿਕਸ਼ਾ ਲੈਂਦੇ ਨੇ ਉਸ ਸ਼ਿਕਸ਼ਾ 'ਚ ਉਹ ਆਪਣੀ ਸ਼ਿਕਸ਼ਾ ਨੂੰ ਨੌਕਰੀ ਵਿੱਚ ਜ਼ਰੂਰ ਬਦਲਦੇ ਨੇ ਜ਼ਿਆਦਾਤਰ ਇੱਦਾਂ ਹੀ ਹੁੰਦਾ ਹੈ ਉਹ ਆਪਣੀ ਮਰਜ਼ੀ ਹੈ ਉਹਨਾਂ ਦੀ ਪਰ ਜ਼ਿਆਦਾਤਰ ਮੈਂ ਇਹ ਹੀ ਸਮਝਦੀ ਹਾਂ ਕਿ ਅਸੀਂ ਜੋ ਪੜ੍ਹ ਰਹੇ ਹਾਂ ਅਸੀਂ ਉਸ ਹੀ ਖੇਤਰ 'ਚ ਜਾ ਕੇ ਨੌਕਰੀ ਕਰਾਂਗੇ ਮੇਰਾ ਇਹ ਹੀ ਮੰਨਣਾ ਹੈ ਆਪਣੇ ਲੈਵਲ ' ਤੇ